ਅੰਮ੍ਰਿਤ ਬਲਜੀਤ ਹਰਪ੍ਰੀਤ ਜਸਪ੍ਰੀਤ ਕਿਰਨ ਮਨਦੀਪ ਨਵਜੋਤ ਪਰਮਿੰਦਰ ਸਿਮਰਨ ਤੇਜਿੰਦਰ ਮਨਿੰਦਰਜੀਤ ਵਿਵੇਕ ਮਨਵੀਰ ਸਿੰਘ ਮਨਰਾਜ ਸਿੰਘ ਮਨਜੋਤ ਸਿੰਘ ਰਵਨਜੋਤ ਸਿੰਘ